ਸਾਡੇ ਸਾਹਮਣੇ ਪਾਰਕ ਦੇ ਵਿੱਚ ਭੰਗੜਾ ਐਰੋਬਿਕਸ ਸਭ ਕੁਝ ਹੁੰਦਾ ਹੈ ਵੱਡੇ ਬਜ਼ੁਰਗ ਜਵਾਨ ਸਭ ਆਉਂਦੇ ਨੇ ਉੱਥੇ ਬੱਚਿਆਂ ਨੇ ਆਪਣੀਆਂ ਅਲੱਗ ਟੋਲੀਆਂ ਬਣਾਈਆਂ ਹੋਈਆਂ ਬੁੱਢਿਆਂ ਨੇ ਆਪਣੀਆਂ ਟੋਲੀਆਂ ਬਣਾਈਆਂ ਜਵਾਨਾਂ ਨੇ ਆਪਣੀਆਂ ਟੋਲੀਆਂ ਬਣਾਈਆਂ ਹੋਈਆ ਔਰ ਸਭ ਆਪਣਾ ਆਪਣਾ ਭੰਗੜਾ ਪਾਉਂਦੇ ਨੇ ਕੋਈ ਐਰੋਬਿਕਸ ਕਰਦਾ ਆਏ ਅਤੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਆਪਣਾ ਆਪਣਾ ਮੰਨੋਰੰਜਨ ਕਰਦੇ ਹਣ ਇਹਦੇ ਨਾਲ ਕੀ ਹੁੰਦਾ ਹੈ ਕਿ ਬਜ਼ੁਰਗ ਆਪਣਾ ਸੋਹਣੇ ਢੰਗ ਦੇ ਨਾਲ ਆਪਣਾ ਸਰੀਰ ਨੂੰ ਐਕਸਰਸਾਈਜ਼ ਯੋਗਾ ਸਭ ਕੁਛ ਕਰ ਲੈਂਦੇ ਹਨ ਬੱਚਿਆਂ ਦਾ ਵੀ ਧਿਆਨ ਇਹਦੇ ਵਿੱਚ ਹੀ ਲੱਗਿਆ ਰਹਿੰਦਾ ਹੈ ਅਤੇ ਆਪਣੇ ਸ਼ਰਾਰਤਾਂ ਵੱਲੋਂ ਧਿਆਨ ਹਟਾ ਕੇ ਆਪਣਾ ਬੜਾ ਸੋਹਣੇ ਢੰਗ ਦੇ ਨਾਲ ਸਾਰਾ ਕੁਛ ਕਰਦੇ ਹਨ ਅਤੇ ਅਤੇ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਮੰਨੋਰੰਜਨ ਕਰਦੇ ਹਨ ਇੱਦਾਂ ਹੀ ਸਾਰੀਆਂ ਜਨਾਨੀਆਂ ਮਹੱਲੇ ਦੀਆਂ ਇਕੱਠੀਆਂ ਹੋ ਕੇ ਪਾਰਕ ਵਿੱਚ ਆ ਜਾਂਦੀਆਂ ਹਨ ਅਤੇ ਆਪਣਾ ਰੋਜ਼ ਸਵੇਰੇ ਅਤੇ ਸ਼ਾਮ ਦੇ ਟਾਈਮ ਉਹਨਾਂ ਨੇ ਬਣਾਏ ਹੋਏ ਹਨ ਆਪਣਾ ਦੋਵੇਂ ਟਾਈਮਾਂ ਤੇ ਆਪਣਾ ਆ ਕੇ ਆਪਣਾ ਬੜਾ ਸੋਹਣੇ ਢੰਗ ਦੇ ਨਾਲ ਕੋਈ ਭੰਗੜਾ ਪਾ ਰਿਹਾ ਹੈ ਕੋਈ ਗਾਣੇ ਲਾ ਕੇ ਆਰੋਬਿਕਸ ਕਰ ਰਿਹਾ ਹੈ